ਹੈਲੋ ਹਾਂ ਵਨੀਤਾ ਕੀ ਹਾਲ ਹੈ ਬਸ ਵਧੀਆ ਵਧੀਆ ਹੋਰ ਕੀ ਚੱਲ ਰਿਹਾ ਅੱਛਾ ਅੱਛਾ ਕਿਚਨ 'ਚ ਕੀ ਬਣਾ ਰਹੀ ਸੀ ਅੱਛਾ ਅੱਛਾ ਚਲੋ ਵਧੀਆ ਵਧੀਆ ਮੈਂ ਕਹਿ ਰਹੀ ਸੀਗੀ ਆਪਣੀ ਕੀ ਕਹਿੰਦੇ ਆ ਇਸ ਸ਼ਨੀਵਾਰ ਨੂੰ ਡਾਂਡੀਆ ਨਾਈਟ ਹੈਗੀ ਹੈ ਅਤੇ ਹਾਂ ਇਸ ਸ਼ਨੀਵਾਰ ਨੂੰ ਰਾਤ ਅੱਠ ਵਜੇ ਤੋਂ ਸ਼ੁਰੂ ਹੋਵੇਗੀ ਹੈ ਅਤੇ ਮੈਂ ਪੁੱਛ ਰਹੀ ਸੀ ਆਪਾਂ ਚੱਲੀਏ ਹਾਂ ਆਪਣੇ ਨਾਲ ਦੀ ਕਲੋਨੀ ਦੇ ਵਿੱਚ ਹੋ ਰਿਹਾ ਹਾਂ ਨਾਲ ਦੀ ਜਿਹੜੀ ਮਿੱਡਾ ਆਪਣੀ ਕਲੋਨੀ ਹੈਗੀ ਹੈ ਨਾ ਉੱਥੇ ਉਹਨਾਂ ਨੇ ਰੱਖਿਆ ਹੈਗਾ ਉਥੇ ਇਕ ਹਾਲ ਬੁੱਕ ਕੀਤਾ ਹੋਇਆ ਡਾਡੀਆਂ ਨਾਇਟ ਲਈ ਹਾਂ ਅਤੇ ਆਪਾਂ ਡਰੈਸ ਕਿਹੜੀ ਪਾਵਾਂਗੇ ਡਰੈਸ ਕੋਡ ਉਹਨਾਂ ਨੇ ਉਹੀ ਬਸ ਜਿਹੜਾ ਮੇਨ ਹੁੰਦਾ ਡਾਡੀਆਂ ਨਾਈਟਸ ਦਾ ਗਾਗਰਾ ਚੋਲੀ ਉਹ ਉਹੀ ਕਹਿੰਦੇ ਉਹੀ ਪਾ ਕੇ ਆਇਓ ਅਤੇ ਮੈਂ ਕਹਿੰਦੀ ਸੀ ਕਿ ਆਪਾਂ ਬਲੈਕ ਕਲਰ ਦਾ ਸਿਲਵਾ ਲੈਂਦੇ ਹਾਂ ਗਾਹਗ੍ਰਾ ਚੋਲੀ ਹੋਰ ਉਹਨੂੰ ਬਸ ਆਪਾਂ ਨਾਪ ਦੇ ਆਵਾਂਗੇ ਅਗਲੇ ਸ਼ਨੀਵਾਰ ਹੈਗੇ ਦੋ ਦਿਨ ਦੋ ਦਿਨ ਦੇ ਵਿੱਚ ਉਹਨੇ ਸੀ ਕੇ ਦੇ ਦੇਣਾ ਉਹਨੂੰ ਕਹਿ ਦਾਂਗੇ ਆਪਾਂ ਭਾਵੇਂ ਸਟੀਚਿੰਗ ਜ਼ਿਆਦਾ ਲੈ ਲਈ ਪਰ ਸਾਨੂੰ ਦੋ ਦਿਨ ਦੇ ਵਿੱਚ ਕੱਪੜੇ ਸਾਡੇ ਤਿਆਰ ਚਾਹੀਦੇ ਆ ਹਾਂ ਅਤੇ ਬੱਚਿਆਂ ਨੂੰ ਕਿਵੇਂ ਕਰਨਾ ਬੱਚਿਆਂ ਨੂੰ ਵੀ ਲੈ ਕੇ ਚੱਲੀਏ ਨਾ ਉਹ ਵੀ ਉਥੇ ਨੱਚ ਟੱਪ ਲੈਣਗੇ ਕੋਈ ਗੱਲ ਨਹੀਂ ਆਪ ਸਾਂਭ ਲੈਣ ਬੱਚੇ ਵੀ ਇੰਜੋਏ ਕਰ ਲੈਣਗੇ ਅਤੇ ਆਪਣਾ ਵੀ ਐਂਟਰਟੇਨ ਹੋ ਜਾਏਗਾ ਆਪਾਂ ਵੀ ਥੋੜ੍ਹਾ ਬਹੁਤ ਬਾਹਰ ਨਿਕਲਾਂਗੀਆਂ ਸਾਰਾ ਦਿਨ ਕਿਚਨ 'ਚ ਵੜੀਆਂ ਰਹਿੰਦੀਆਂ ਮੈਂ ਕੁਛ ਨਹੀਂ ਬਸ ਬੱਚਿਆਂ ਨੂੰ ਟਿਊਸ਼ਨ ਛੋੜ ਕੇ ਆਈ ਹਾਂ ਹੁਣ ਚਾਹ ਵਗੈਰਾ ਬਣਾਵਾਂਗੀ ਅਤੇ ਥੋੜ੍ਹਾ ਆਰਾਮ ਕਰਾਂਗੀ ਫੇਰ ਉਸ ਤੋਂ ਬਾਅਦ ਆਪਾਂ ਉਹੀ ਇੱਕ ਕੰਮ ਕਿਚਨ 'ਚ ਕੁਛ ਬਣਾਉਣ ਸਾਰੇ ਆਉਣਗੇ ਤਾਂ ਹਾਂ ਨਹੀਂ ਇਹ ਦੂਸਰੀ ਸੋਸਾਇਟੀ ਹੀ ਕਰਵਾ ਰਹੀ ਹੈ ਉਹਨਾਂ ਦੇ ਉਹਨਾਂ ਨੇ ਪਹਿਲਾਂ ਹੀ ਇਹ ਐਡਮਿਸ਼ਨ ਕੀਤੀ ਹੋਈ ਹੈ ਮਤਲਬ ਸਾਰੀ ਸੁਸਾਈਟੀ ਤੋਂ ਪੈਸੇ ਇਕੱਠੇ ਕਰਕੇ ਨਾ ਫਿਰ ਇਹ ਵਾਲਾ ਪ੍ਰੋਗਰਾਮ ਕੀਤਾ ਉਹਨਾਂ ਨੇ ਸੈੱਟ ਪਹਿਲਾਂ ਹੀ ਉਹਨਾਂ ਨੇ ਲਿਆ ਹੋਇਆ ਸਭ ਸਾਰਿਆਂ ਕੋਲੋਂ ਠੀਕ ਹੈ ਹਾਂ ਚਲੋ ਆਪਾਂ ਮਿਲਦੇ ਹਾਂ ਹੈਂ ਹਾਂ ਸ਼ਾਮੀ ਮਿਲ ਕੇ ਗੱਲ ਕਰਦੇ ਹਾਂ ਠੀਕ ਹੈ ਚੱਲ ਠੀਕ ਹੈ ਓਕੇ